ਸਾਡੇ ਇਹਦੇ ਵਿੱਚ ਪੰਜਾਬ ਵਿੱਚ ਸੱਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਤੁਸੀਂ ਇਹ ਪੁੱਛ ਰਹੇ ਹੋ ਕਿਸਾਨਾਂ ਦੇ ਖੁਦਕੁਸ਼ੀ ਬਾਰੇ ਹੈ ਨਾ ਬਹੁਤ ਕਿਸਾਨ ਲੋਕ ਹੈਗੇ ਜਿਹੜੇ ਖੁਦਕੁਸ਼ੀਆਂ ਦੇ ਹੱਥ ਪੈ ਗਏ ਹੈ ਉਹਨਾਂ ਕੋਲੇ ਹੋਰ ਕੋਈ ਹੱਲ ਹੀ ਹੈ ਨਹੀਂ ਖੁਦਕੁਸ਼ੀ ਤੋਂ ਬਿਨਾਂ ਕਿਉਂਕਿ ਸਰਕਾਰ ਜਿਹੜੀ ਉਹਨਾਂ ਨੂੰ ਫਸਲਾਂ ਦਾ ਉਹਨਾਂ ਦਾ ਸਹੀ ਮੁੱਲ ਨਹੀਂ ਦੇ ਰਹੀ ਹੈ ਨਾ ਅਤੇ ਜਿਹੜਾ ਗਰੀਬ ਕਿਸਾਨ ਆ ਉਹ ਕੀ ਕਰੂਗਾ ਕਰਜ਼ਾ ਚੁੱਕੂਗਾ ਹੈ ਨਾ ਮਤਲਬ ਜੇ ਉਹ ਨੈਚੂਰਲੀ ਗੱਲ ਹੈ ਕਰਜ਼ਾ ਚੁੱਕੂਗਾ ਤਾਂ ਉਹ ਫ਼ਸਲ ਮਰ ਜਾਂਦੀ ਹੈ ਅਤੇ ਮਤਲਬ ਬੰਦਾ ਉਹ ਕਰਜ਼ਾ ਕਿੱਥੋਂ ਲਾਊਗਾ ਉਹ ਕਰਜ਼ੇ ਹੇਠਾਂ ਆ ਜਾਂਦਾ ਹੈ ਨਾ ਅਤੇ ਸਾਡੇ ਮਤਲਬ ਪੰਜਾਬ 'ਚ ਕਿ ਲੋਕ ਕਿਸਾਨ ਖੁਦਕੁਸ਼ੀਆਂ ਮਤਲਬ ਕਰ ਰਹੇ ਹਨ ਖੁਦਕੁਸ਼ੀਆਂ ਦੇ ਰਾਹ ਪੈ ਕੇ ਉਹਨਾਂ ਕੋਲ ਹੋਰ ਕੋਈ ਹੱਲ ਹੀ ਹੈ ਨਹੀਂ ਗਾ ਹੋਰ ਕੁਛ ਸਲਿਉਸ਼ਨ ਹੈ ਨਹੀਂ ਉਹਨਾਂ ਕੋਲ ਸਰਕਾਰ ਵੈਸੇ ਤਰ੍ਹਾਂ ਤਰ੍ਹਾਂ ਦੇ ਟਾਇਮ ਟਾਇਮ 'ਤੇ ਕਰ ਰਹੀ ਹੈ ਪਰ ਸਰਕਾਰ ਨੂੰ ਮਤਲਬ ਇਹ ਚਾਹੀਦਾ ਮਤਲਬ ਉਹਨਾਂ ਲਈ ਜਿਹੜੀ ਕਿਸਾ ਫਸਲਾਂ ਦਾ ਮੁੱਲ ਹੈ ਹੈ ਨਾ ਉਹ ਮਤਲਬ ਸਹੀ ਪਾਇਆ ਜਾਵੇ ਫਸਲਾਂ ਦਾ ਮੁੱਲ ਕਿਉਂਕਿ ਗਰੀਬ ਕਿਸਾਨ ਵੱਡਾ ਕਿਸਾਨ ਜਰ ਸਕਦਾ ਹੈ ਪਰ ਜਿਹੜਾ ਗਰੀਬ ਕਿਸਾਨ ਹੈ ਉਹ ਮਤਲਬ ਨਹੀਂ ਉਹ ਕਰ ਸਕਦਾ ਗਾ ਹੈ ਨਾ ਜਿਹਨਾਂ ਨੂੰ ਫਸਲਾਂ ਦਾ ਗਰੀਬ ਕਿਸਾਨ ਨੂੰ ਫਸਲਾਂ ਦਾ ਮੁੱਲ ਮਿਲੂ ਉਹ ਸਹੀ ਤਾਂ ਉਹ ਮਤਲਬ ਜਿਹੜਾ ਉਹ ਦੋ ਰੁਪਈਏ ਕਮਾ ਸਕਦਾ ਹੈ ਨਾ ਅਤੇ ਉਹ ਮਤਲਬ ਖੁਦਕੁਸ਼ੀਆਂ ਤੋਂ ਬੱਚ ਸਕਦਾ ਗਰੀਬ ਕਿਸਾਨਾਂ ਨੂੰ ਸਹੀ ਫਸਲਾਂ ਦਾ ਮੁੱਲ ਹੀ ਨਹੀਂ ਮਿਲ ਰਿਹਾ ਰੇਹਾਂ ਸਪਰੇਹਾਂ ਗਲਤ ਰੇਟਾਂ 'ਤੇ ਮਿਲ ਰਹੀਆਂ ਹੈ ਜੋ ਉਹਨਾਂ ਦਾ ਰੇਟ ਵੀ ਸਹੀ ਹੋ ਜਾਵੇ ਅਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਕਿਸਾਨ ਖੁਦਕੁਸ਼ੀ ਕਰੂਗਾ ਬੰਦਾ ਕੋਈ ਵੀ ਮਰ ਕੇ ਰਾਜੀ ਨਹੀਂ ਹੁੰਦਾ ਪਰ ਕਿਸਾਨ ਕੋਲ ਕੋਈ ਹੋਰ ਹੱਲ ਹੀ ਹੈ ਨਹੀਂ ਜਿਹੜਾ ਗਰੀਬ ਕਿਸਾਨ ਹੈ ਉਹਨਾਂ ਦੇ ਕੋਲ ਹੋਰ ਕੋਈ ਹੱਲ ਹੀ ਹੈ ਨਹੀਂ ਖੁਦਕੁਸ਼ੀ ਤੋਂ ਬਿਨਾਂ ਜੇ ਉਹ ਖੁਦਕੁਸ਼ੀ ਮਤਲਬ ਉਹਨਾਂ ਨੂੰ ਸਹੀ ਰੇਟ ਮਿਲੇ ਤਾਂ ਖੁਦਕੁਸ਼ੀ ਨਾ ਕਰੇ ਉਹ